ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਦਵਾਈ ਆਪਣੇ ਫਾਰਮੇਸੀ ਐਪ ਤੋਂ ਆਰਡਰ ਕੀਤਾ ਹੈ ਅਤੇ ਇਹ ਐਪ ਇਸ ਦਵਾਈ ਦੀ ਮੈਨੂੰ ਬਹੁਤ ਜ਼ਰੂਰਤ ਹੈ ਤਾਂ ਮੈਂ ਇਸ ਦਵਾਈ ਦੀ ਟਰੈਕਿੰਗ ਕਰਨਾ ਚਾਹੁੰਦਾ ਹਾਂ ਇਸ ਆਰਡਰ ਨੂੰ ਟ੍ਰੈਕ ਕਰਨ ਲਈ ਮੇਰਾ ਟਰੈਕਿੰਗ ਆਰਡਰ ਨੋਟ ਕੀਤਾ ਜਾਵੇ ਜੋ ਕਿ ਹੈ ਇੱਕ ਜ਼ੀਰੋ ਦੋ ਤਿੰਨ ਅੱਠ ਇਸ ਦੀ ਜਲਦੀ ਤੋਂ ਜਲਦੀ ਟਰੈਕਿੰਗ ਕਰਕੇ ਮੈਨੂੰ ਖਬਰ ਕੀਤੀ ਜਾਵੇ ਤਾਂ ਜੋ ਕਿ ਇਸ ਦਵਾਈ ਨੂੰ ਮੈਂ ਸਮੇਂ ਸਿਰ ਵਰਤ ਸਕਾਂ ਅਤੇ ਮੇਰੇ ਲਾਭਦਾਇਕ ਹੋ ਸਕੇ ਅਤੇ ਇਸ ਫਾਰਮੈਸੀ ਦੀ ਵੈਬਸਾਈਟ ਦੀਆਂ ਸੇਵਾਵਾਂ ਨੂੰ ਵੀ ਚੰਗੀ ਤਰ੍ਹਾਂ ਸਹੀ ਮੁਹੱਈਆ ਕਰਾਇਆ ਜਾਵੇ ਤਾਂ ਜੋ ਅਸੀਂ ਆਪਣੇ ਆਪ ਹੀ ਆਪਣੀ ਦਵਾਈ ਦੀ ਆਈ ਡੀ ਭਰ ਕੇ ਉਹਨੂੰ ਟਰੈਕ ਕਰ ਸਕੀਏ ਅਤੇ ਆਪਣੀ ਡਿਲਵਰੀ ਸੇਵਾਵਾਂ ਨੂੰ ਵੀ ਤੇਜ਼ ਰੱਖਿਆ ਜਾਵੇ ਧੰਨਵਾਦ